ਮੇਰੇ ਪਸੰਦੀਦਾ ਗੀਤ ਹਨ ਜੋ ਸਭ ਤੋਂ ਪਹਿਲਾ ਗੀਤ ਹੈ ਮੇਰਾ ਜੋ ਸਿੰਗਰ ਰਣਜੀਤ ਬਾਵਾ ਜੀ ਦਾ ਫਤਿਹ ਉਹ ਫਤਿਹ ਗੀਤ ਸਿੱਖ ਧਰਮ ਦੇ ਨਾਲ਼ ਸੰਬੰਧਿਤ ਗੀਤ ਹੈ ਕਿ ਕਿਸ ਪ੍ਰਕਾਰ ਸਿੱਖੀ ਪ੍ਰਾਪਤ ਕੀਤੀ ਗਈ ਸੀ ਔਰ ਕਿਸ ਪ੍ਰਕਾਰ ਪੂਰਵਜ ਨੇ ਸਿੱਖਾਂ ਦੇ ਉੱਪਰ ਜੋ ਤਸੀਹੇ ਦਿੱਤੇ ਜਾਂਦੇ ਸੀ ਸਾਡੇ ਜਿੰਨੇ ਵੀ ਗੁਰੂ ਹੋਏ ਆ ਉਹਨਾਂ ਨੇ ਕਿਸ ਪ੍ਰਕਾਰ ਤਸੀਹੇ ਝੱਲੇ ਔਰ ਕਿਵੇਂ ਸਿੱਖੀ ਪ੍ਰਾਪਤ ਕੀਤੀ ਉਸ ਇਸ ਗੀਤ ਨੂੰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਜੋਸ਼ ਆਉਂਦਾ ਔਰ ਇਸ ਗੀਤ ਨੂੰ ਜਦੋਂ ਸੁਣਦਾ ਹਾਂ ਤਾਂ ਮੇਰੇ ਅੰਦਰ ਦੇਸ਼ ਭਗਤੀ ਜਾਗਦੀ ਹੈ ਔਰ ਮੈਨੂੰ ਲੱਗਦਾ ਕਿ ਮੈਂ ਦੇਸ਼ ਵਾਸਤੇ ਕੁਛ ਵੀ ਕਰ ਸਕਦਾ ਹਾਂ ਇਸ ਤੋਂ ਬਿਨਾ ਇੱਕ ਬਹੁਤ ਹੀ ਪ੍ਰਸਿੱਧ ਗੀਤ ਹੋਇਆ ਸੀ ਸਾਡੇ ਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਇਹ ਚਮਕੀਲਾ ਜੀ ਦਾ ਗੀਤ ਗਾਇਆ ਹੋਇਆ ਔਰ ਇਹ ਗੁਰਦੁਆਰਾ ਨਨਕਾਣਾ ਸਾਹਿਬ ਦੇ ਉੱਪਰ ਬੋਲਿਆ ਗਿਆ ਔਰ ਇਸ ਗੀਤ ਦੇ ਜਦੋਂ ਸੁਣਦੇ ਹਾਂ ਬੋਲ ਸੁਣਦੇ ਹਾਂ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਔਰ ਜੀ ਕਰਦਾ ਕਿ ਵਾਰ ਵਾਰ ਇਸ ਗੀਤ ਨੂੰ ਸੁਣਿਆ ਜਾਵੇ ਇਸ ਤੋਂ ਬਿਨਾ ਇੱਕ ਬਹੁਤ ਹੀ ਮਕਬੂਲ ਗੀਤ ਹੋਇਆ ਸੀ ਕਿ ਜੋ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ ਇਹ ਬਹੁਤ ਹੀ ਨਵਾਂ ਸਿੰਗਰ ਸੀ ਇਹ ਹਸਾਬਾਦ ਪਿੰਡ ਤੋਂ ਔਰ ਬਹੁਤ ਵਧੀਆ ਸੀ ਇਹ ਇੱਕ ਸਿਖਸ਼ਾ ਦਿੰਦਾ ਕਿਸ ਕਿਸ ਪ੍ਰਕਾਰ ਸਾਡੇ ਮਾਂ ਬਾਪ ਸਾਨੂੰ ਪੜ੍ਹਾਉਂਦੇ ਹੈ ਲਿਖਾਉਂਦੇ ਹੈ ਔਰ ਨੌਕਰੀ ਤੱਕ ਪਹੁੰਚਾਉਂਦੇ ਹੈ ਬਾਅਦ ਵਿੱਚ ਜ਼ਿੰਦਗੀ ਜੀਣ ਦਾ ਸਲ਼ੀਕਾ ਸਿਖਾਉਂਦੇ ਹੈ ਉਹ ਸਾਰਾ ਇਸ ਗੀਤ ਦੇ ਵਿੱਚ ਦਰਸਾਇਆ ਗਿਆ ਹੈ ਉਸ ਤੋਂ ਬਿਨਾ ਸਤਿੰਦਰ ਸਰਤਾਜ ਜੀ ਦੇ ਗੀਤ ਬਹੁਤ ਜ਼ਿਆਦਾ ਸੁਣਦੇ ਉਨ੍ਹਾਂ ਦੀ ਬੜੀ ਵਧੀਆ ਸੇਧ ਹੁੰਦੀ ਹੈ ਗੀਤਾਂ ਦੇ ਵਿੱਚ ਔਰ ਗੁਰਦਾਸ ਮਾਨ ਜੀ ਦੇ ਗੀਤ ਬਹੁਤ ਵਧੀਆ ਲੱਗਦੇ ਹੈ ਔਰ ਸਤਿੰਦਰ ਸਰਤਾਜ ਜੀ ਦਾ ਗੀਤ ਸੀ ਕਿ ਕੁੜੀ ਨੇ ਲੱਕੜਾਂ ਦੀ ਪੰਡ ਸਿਰ ਦੇ ਉੱਪਰ ਰੱਖੀ ਹੋਈ ਸੀ ਔਰ ਕਿਵੇਂ ਮਜ਼ਦੂਰੀ ਕਰਕੇ ਉਹ ਕੁੜੀ ਆਪਣਾ ਪੇਟ ਪਾਲ਼ਦੀ ਆ ਉਸਦੇ ਉੱਪਰ ਗੀਤ ਗਾਇਆ ਸੀ ਉਨ੍ਹਾਂ ਨੇ ਔਰ ਅਕਸਰ ਇਹ ਗੀਤ ਮੈਂ ਘਰ ਜਾਂ ਜਾਂਦੇ ਆਉਂਦੇ ਗੱਡੀ ਦੇ ਵਿੱਚ ਜਾਂ ਜਵਾਨੀ ਵੇਲੇ ਬਹੁਤ ਜ਼ਿਆਦਾ ਗੀਤ ਮੈਂ ਸੁਣੇ ਹੈ ਔਰ ਬਹੁਤ ਵਧੀਆ ਲੱਗਦਾ ਹੈ